ਅੱਜ ਕੱਲ੍ਹ ਰੇਲਵੇ ਦੀ ਜਿਹੜੀ ਵੀ ਜਾਂਚ ਕਰਨੀ ਹੈ ਉਹਦੇ ਵਾਸਤੇ ਸਾਨੂੰ ਕਿਸੇ ਨੂੰ ਵੀ ਪੁੱਛਣ ਦੀ ਲੋੜ ਨਹੀਂ ਹੈਗੀ ਜਿਹੜਾ ਕਿ ਰੇਲਵੇ ਹੈਗਾ ਉਹਨਾਂ ਨੇ ਇੱਕ ਬਹੁਤ ਵਧੀਆ ਸਿਸਟਮ ਸੈਟਅਪ ਕੀਤਾ ਹੈਗਾ ਉਹਦਾ ਨਾਮ ਹੈ ਆਈ ਆਰ ਟੀ ਸੀ ਦੀ ਵੈੱਬਸਾਈਟ 'ਤੇ ਇਹ ਰੇਲਵੇ ਦੀ ਜਿਹੜੀ ਸਰਕਾਰ ਵੱਲੋਂ ਜਾਰੀ ਕੀਤੀ ਵੈੱਬਸਾਈਟ ਹੈਗੀ ਹੈ ਇਹਦੇ ਉੱਤੇ ਜਾ ਕੇ ਜੇ ਅਸੀਂ ਆਪਣਾ ਟ੍ਰੇਨ ਨੰਬਰ ਅਤੇ ਆਪਣਾ ਟ੍ਰੇਨ ਦਾ ਨਾਮ ਉਹਦੇ ਉੱਤੇ ਪਾਵਾਂਗੇ ਤਾਂ ਸਾਨੂੰ ਟ੍ਰੇਨ ਕਿੱਥੇ ਪਹੁੰਚੀ ਕਿੰਨੇ ਮਿੰਟ ਲੇਟ ਹੈ ਅਤੇ ਕਿੰਨੇ ਮਿੰਟ ਜਲਦੀ ਹੈ ਉਹਦੇ ਬਾਰੇ ਸਾਨੂੰ ਸਾਰੀ ਜਾਣਕਾਰੀ ਉਹਦੇ ਉੱਤੇ ਮਿਲ ਜਾਵੇਗੀ ਅਤੇ ਜੇ ਮੈਂ ਟ੍ਰੇਨ ਲੈਣੀ ਹੈ ਅਤੇ ਮੈਨੂੰ ਪਤਾ ਕਰਨਾ ਹੈ ਕਿ ਜਿਹੜੀ ਟ੍ਰੇਨ ਮੈਂ ਲੈਣੀ ਹੈ ਉਹ ਟਾਈਮ 'ਤੇ ਹੈਗੀ ਹੈ ਕਿ ਨਹੀਂ ਉਹ ਟਾਈਮ 'ਤੇ ਪਹੁੰਚੇਗੀ ਕਿ ਨਹੀਂ ਉਹਦੇ ਬਾਰੇ ਮੈਨੂੰ ਸਾਰੀ ਜਾਣਕਾਰੀ ਆਈ ਆਰ ਟੀ ਸੀ ਦੀ ਸਾਈਟ 'ਤੇ ਜਾ ਕੇ ਮਿਲ ਜਾਵੇਗੀ ਇਹਦੇ ਵਾਸਤੇ ਅਸੀਂ ਆਪਣਾ ਰੇਲਵੇ 'ਤੇ ਅਕਾਊਂਟ ਬਣਾ ਸਕਦੇ ਹਾਂ ਅਤੇ ਕਦੇ ਵੀ ਉਹਦੇ ਉੱਤੇ ਪਾ ਕੇ ਚੈੱਕ ਕਰ ਸਕਦੇ ਹਾਂ ਕਿ ਜਿਹੜੀ ਵੀ ਟ੍ਰੇਨ ਅਸੀਂ ਲੈਣੀ ਹੈ ਉਹ ਕਿੰਨੇ ਮਿੰਟ ਲੇਟ ਹੈ ਅਤੇ ਕਦੋਂ ਉਹ ਸਟੇਸ਼ਨ 'ਤੇ ਪਹੁੰਚੇਗੀ